ਅੱਜ ਕੱਲ੍ਹ ਦੇ ਬੱਚੇ ਬਾਹਰ ਖੇਡਣ ਦੀ ਬਜਾਇ ਘਰ ਵਿੱਚ ਲੈਪਟੋਪ ਅਤੇ ਮੋਬਾਇਲ 'ਤੇ ਖੇਡਣਾ ਜਾਂ ਟੀ ਵੀ ਦੇਖਣਾ ਜ਼ਿਆਦਾ ਪਸੰਦ ਕਰਦੇ ਆ ਜਦੋਂ ਕਿ ਇਹ ਬਹੁਤ ਹੀ ਗਲਤ ਹੈ ਕਿਉਂਕਿ ਇੱਕ ਤਾਂ ਇਹਦੇ ਨਾਲ ਸਿਹਤ ਨੂੰ ਤਾਂ ਸੇ ਅੱਖਾਂ ਦਾ ਬੱਚਿਆਂ ਦੀ ਦੇਖੋ ਛੋਟੇ ਛੋਟੇ ਬੱਚਿਆਂ ਨੂੰ ਐਨਕਾਂ ਲੱਗੀਆਂ ਹੁੰਦੀਆਂ ਉਹਨਾਂ ਦੇ ਬੈਠ ਸਾਰੇ ਦਿਨ ਬੈਠੇ ਰਹਿਣਾ ਬੈਕ ਦੀ ਪ੍ਰੋਬਲਮ ਆ ਰਹੀ ਹੈ

ਉਹਦੇ ਨਾਲ ਕੀ ਆ ਕਿ ਸਰੀਰ ਦਾ ਸਟੈਮਿਨਾ ਵੀ ਬਣਦਾ ਦੂਸਰਾ ਹੈ ਕਿ ਸਾਨੂੰ ਬਾਹਰ ਦੀ ਔਕਸੀਜਨ ਮਿਲਦੀ ਆ ਬੱਚ ਕਿਉਂਕਿ ਸਿਰਫ਼ ਇੱਕ ਬੈਠੇ ਰਹਿ ਕੇ ਬੱਚੇ ਜਿਹੜੇ ਗੇਮਾਂ ਖੇਡਦੇ ਆ ਉਹਦੇ ਨਾਲ ਕੀ ਹੁੰਦਾ ਕਿ ਆਉਣ ਵਾਲੇ ਟਾਈਮ 'ਚ ਅਸੀਂ ਜਦੋਂ ਅੱਗੇ ਸੰਘਰਸ਼ ਕਰਨੇ ਆ ਉਹ ਤਾਂ ਸਰੀਰ ਪਹਿਲਾਂ ਹੀ ਸਾਡਾ ਕਮਜ਼ੋਰ ਹੋ ਚੁੱਕਾ ਹੁੰਦਾ ਹੈ ਅਤੇ ਉਹਦੇ ਵਾਸਤੇ ਅਸੀਂ ਤਿਆਰ ਹੀ ਨਹੀਂ ਹੁੰਦੇ ਬੱਚੇ ਇਸ ਵਿੱਚ ਬੱਚਿਆਂ ਨੂੰ ਚਾਹੀਦਾ ਕਿ ਪ੍ਰਾਕਿਰਤਿਕ ਗੇਮਾਂ ਖੇਡਣ ਨਾ ਕਿ ਮੋਬਾਇਲ ਲੈ ਕੇ ਲ ਲੈਪਟੋਪ ਲੈ ਕੇ ਜਾਂ ਸਾਰਾ ਸਾਰਾ ਦਿਨ ਟੀ ਵੀ ਦੇ ਅੱਗੇ ਬੈਠੇ ਰਹਿਣ ਤਾਂ ਉਹਨੇ ਪਬਜੀ ਗੇਮਾਂ ਖੇਡਦੇ ਆ ਇੱਥੋਂ ਤੱਕ ਉਹਨਾਂ ਨੂੰ ਸੁੱਤੇ ਪਿਆ ਵੀ ਇਹਨਾਂ ਦੇ ਦਿਮਾਗ 'ਚ ਉਹੀਓ ਕੁਛ ਚੱਲਦਾ ਰਹਿੰਦਾ ਜਦੋਂ ਵੀ ਦੇਖੋ ਹਰ ਵਿੱਚ ਹਰ ਘਰ 'ਚ ਜਿੱਥੇ ਮਰਜੀ ਦੇਖ ਲਿਓ ਅੱਜ ਕੱਲ੍ਹ ਸਾਰੇ ਬੱਚਿਆਂ ਦੇ ਕੋਲ ਫੋਨ ਹੈਗੇ ਆ ਅਤੇ ਫੋਨ ਦੇ ਉੱਤੇ ਤੁਹਾਨੂੰ ਪਤਾ ਸਾਰੇ ਬੱਚੇ ਕੋਈ ਮਤਲਵ ਕਿ ਇੱਕ ਦੂਸਰੇ ਵੱਲ ਧਿਆਨ ਨਹੀਂ ਦਿੰਦਾ ਸਭ ਆਪਣੇ ਫੋਨ 'ਤੇ ਲੱਗੇ ਹੁੰਦੇ ਆ ਬੱਚਿਆਂ 'ਚ ਇਹਦਾ ਕਿ ਜ਼ਿਆਦਾ ਜ਼ਿਆਦਾ ਬਾਹਰ ਗੇਮਾਂ ਖੇਡਣ ਆਪਣੀ ਸਿਹਤ ਠੀਕ ਕਰਨ ਤਾਂ ਕਿ ਇਹੀ ਆਉਣ ਵਾਲੇ ਟਾਈਮ ਦਾ ਭਵਿੱਖ ਹੈਗਾ ਬੱਚੇ ਹੀ ਭਵਿੱਖ ਨੇ ਆਉਣ ਵਾਲੇ ਟਾਈਮ ਦੇ